ਹਾਂਜੀ ਅਸੀਂ ਆਪਣੇ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਚਿੱਤਰਕਾਰੀ ਸਿੱਖੀ ਸੀ ਜਿਵੇਂ ਸਕੂਲ ਦੇ ਵਿੱਚ ਥੋੜ੍ਹੇ ਜਿਹੇ ਦਿਨਾਂ ਤੋਂ ਬਾਅਦ ਹੈ ਨਾ ਹੁਣ ਬੱਚਿਆਂ ਨੂੰ ਡਰਾਇੰਗ ਕਰਨੀ ਸਿਖਾ ਦਿੰਦੇ ਨੇ ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਸਾਨੂੰ ਉਹਨਾਂ ਨੇ ਝੌਂਪੜੀ ਬਣਾਉਣੀ ਸਿਖਾਈ ਸੀ ਵੀ ਕਿੱਦਾਂ ਝੌਂਪੜੀ ਬਣਾਉਣੀ ਆ ਕਿੱਦਾਂ ਉਹ 'ਚ ਦਰਵਾਜ਼ੇ ਫਿੱਟ ਕਰਨੇ ਨੇ ਇਹ ਸਾਰਾ ਕੁਛ ਜਿਵੇਂ ਕਿ ਕਿੱਦਾਂ ਉਹਦੇ ਨੀਚੇ ਗ੍ਰਾਸ ਦਿਖਾਉਣਾ ਕਿੱਦਾਂ ਕਾਂ ਉੱਡਦੇ ਨੇ ਇਸ ਬਾਰੇ ਨਾ ਜਿਹੜਾ ਸੁਣਿਆ ਸੀ ਕਾਲਜ ਜਾਂ ਕੋਰਸ ਨੇ ਜਿਹੜੇ ਇਹ ਗੁਰੂਕਲ ਅਕੈਡਮੀਆਂ ਨੇ ਜਿਹੜੀਆਂ ਉਹਦੇ 'ਚ ਬਹੁਤ ਵਧੀਆ ਆਰਟ ਦੇ ਰਿਲੇਟਡ ਕੋਰਸ ਨੇ ਜਿਹੜੇ ਕਰਵਾਏ ਜਾਂਦੇ ਨੇ ਸਾਡੀ ਆਪਣੀ ਕਲਾ ਕੈਰੀਅਰ ਲਈ ਕੋਈ ਟੀਚੇ ਜਾਂ ਇਸ਼ਾਵਾਂ ਨਹੀਂ ਹਨ ਕਿਉਂਕਿ ਅਸੀਂ ਇਹਨੂੰ ਆਪਣੀ ਹੋਬੀ ਰੱਖਿਆ ਹੋਇਆ ਜਦੋਂ ਵੀ ਮੈਨੂੰ ਟਾਈਮ ਹੁੰਦਾ ਮੈਂ ਆਪਣੇ ਫ੍ਰੀ ਟਾਈਮ ਦੇ ਵਿੱਚ ਆਪਣੀ ਜਿਹੜੀ ਇਹ ਕਲਾ ਜਿਹੜੀ ਹੈ ਨਾ ਚਾਹੇ ਉਹ ਝੌਂਪੜੀ ਲਾ ਲਓ ਜਾਂ ਕੋਈ ਵੀ ਡੱਕ ਵਗੈਰਾ ਪੰਛੀਆਂ ਦੀਆਂ ਉਹ ਲਾ ਲਓ ਉਹ ਤੁਸੀਂ ਪੇਂਟਿੰਗ ਕਰਦੇ ਰਹਿੰਨੇ ਆ ਪਰ ਉਹਨਾਂ ਨੂੰ ਪ੍ਰਾਪਤ ਕਰਨ ਲਈ ਕੋਈ ਮੇਨ ਜਿਹੜੇ ਪਲੈਨ ਅਸੀਂ ਯੋਜਨਾ ਉਹ ਨਹੀਂ ਬਣਾਇਆ ਹਾਲੇ ਤੱਕ